ਅੱਜ ਦੇ ਅਜੋਕੇ ਯੁੱਗ ਵਿੱਚ ਖਬਰਾਂ ਦੀ ਪਾਲਣਾ ਨੌਜਵਾਨ ਪੀੜ੍ਹੀ ਨੂੰ ਅਪਡੇਟ ਰਹਿਣ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਕੋਈ ਵੀ ਜੋਬ ਆਉਂਦੀ ਹੈ ਉਹਦੀ ਰਿਕੁਆਇਰਮੈਂਟ ਆਉਂਦੀ ਹੈ ਉਹ ਵੀ ਖਬਰਾਂ ਚਾਹੇ ਟੀਵੀ ਦੇ ਮਾਧਿਅਮ ਰਾਹੀਂ ਆ ਜੇ ਚਾਹੇ ਨਿਊਜ਼ਪੇਪਰ ਦੇ ਮਾਧਿਅਮ ਰਾਹੀਂ ਚਾਹੇ ਆਪਣੇ ਇੰਟਰਨੈਟ ਮੋਬਾਈਲ ਦੇ ਮਾਧਿਅਮ ਰਾਹੀਂ ਆ ਜੇ ਸਾਨੂੰ ਅਪ ਟੂ ਡੇਟ ਰਹਿਣ ਲਈ ਖਬਰਾਂ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੈ ਜਿਵੇਂ ਕਿ ਕਰੋਨਾ ਕਾਲ ਦੇ ਵਿੱਚ ਬੰਦੇ ਨੂੰ ਇਹ ਦੱਸਿਆ ਜਾਂਦਾ ਸੀ ਵੀ ਕਿੱਥੇ ਵੈਕਸੀਨ ਹੋ ਰਹੀ ਹੈ ਕਿੱਥੇ ਨਹੀਂ ਹੋਈ ਹੋ ਰਹੀ ਇਹ ਸਾਨੂੰ ਜਾਂ ਤਾਂ ਇੰਟਰਨੈਟ 'ਤੇ ਖਬਰਾਂ ਰਾਹੀਂ ਪਤਾ ਲੱਗਦਾ ਸੀ ਜਾਂ ਟੀਵੀ 'ਤੇ ਜਾਂ ਇੱਕ ਨਿਊਜ਼ਪੇਪਰ ਬਹੁਤ ਹੀ ਵਧੀਆ ਜ਼ਰੀਆ ਜਿੱਥੇ ਤੁਹਾਨੂੰ ਦਿਨ ਭਰ ਦੀਆਂ ਖਬਰਾਂ ਸਵੇਰ ਨੂੰ ਮਿਲਦੀਆਂ ਹਨ ਦੇਖਣ ਨੂੰ ਕਿੱਥੇ ਕੀ ਵਾਪਰਿਆ ਕਿੱਥੇ ਕੀ ਸਹੀ ਹੈ ਕਿੱਥੇ ਕੀ ਗਲਤ ਆ ਇਸੇ ਤਰ੍ਹਾਂ ਜੇ ਆਪਾਂ ਟੀਵੀ ਦੀ ਖ ਲਾ ਲਈਏ ਟੀਵੀ 'ਤੇ ਇੱਕ ਆਉਣ ਵਾਲੀਆਂ ਖਬਰਾਂ ਸਾਰੀ ਦਿਹਾੜੀ ਦਾ ਨਿਚੋੜ ਆਪਾਂ ਨੂੰ ਸ਼ਾਮ ਨੂੰ ਬੈਠ ਕੇ ਜਾਂ ਦੁਪਹਿਰੇ ਜਾਂ ਸਵੇਰੇ ਤਿੰਨੇ ਟਾਈਮ ਖਬਰਾਂ ਦਾ ਆਪਾਂ ਨੂੰ ਪਤਾ ਲੱਗਦਾ ਵੀ ਅੱਜ ਕੀ ਹੋਇਆ ਅਤੇ ਕੀ ਕਰਨਾ ਜੇ ਆਪਾਂ ਇੰਟਰਨੈਟ ਦੀ ਗੱਲ ਕਰ ਲਈਏ ਇੰਟਰਨੈਟ 'ਤੇ ਅੱਜ ਦੇ ਅਜੋਕੇ ਯੁੱਗ ਵਿੱਚ ਬਹੁਤ ਹੀ ਨਿਊਜ਼ ਚੈਨਲ ਬਣੇ ਹਨ ਜੋ ਕਿ ਆਪਾਂ ਨੂੰ ਚੌਵੀ ਘੰਟੇ ਲਾਈਵ ਟੈਲੀਕਾਸਟ ਦੀ ਤਰ੍ਹਾਂ ਆਪਾਂ ਨੂੰ ਅਪਡੇਟ ਰੱਖਦੇ ਹਨ